ਸਾਡੇ ਇਲਾਕੇ ਦਾ ਐਮ ਐਲ ਏ ਭੋਲਾ ਹੈ ਅਤੇ ਉਹਨਾਂ ਨੇ ਬਹੁਤ ਕੰਮ ਕਰਵਾਇਆ ਹੈ ਸੜਕਾਂ ਬਣਵਾਈਆਂ ਨੇ ਪਾਣੀ ਦਾ ਨਿਕਾਸ ਕਰਵਾਇਆ ਹੈ ਬਜ਼ੁਰਗਾਂ ਦੇ ਪੈਸ਼ਨ ਲਗਵਾਈਆਂ ਨੇ ਰਾਸ਼ਨ ਕਾਰਡ ਬਣਵਾਏ ਹੈ ਜਿੱਥੋਂ ਸਾਨੂੰ ਰਾਸ਼ਨ ਮਿਲਦਾ ਹੈ ਫਰੀ 'ਚ ਕਣਕ ਮਿਲਦੀ ਹੈ ਧੰਨਵਾਦ